ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸੱਭਿਆਚਾਰ ਧਾਰਮਿਕ ਤਿਉਹਾਰ ਅਤੇ ਲੋਕ ਤਿਉਹਾਰ ਬਹੁਤ ਹੀ ਪੁਰਾਣਾ ਇਤਿਹਾਸ ਹੈ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਦੇ ਅਨੁਸਾਰ ਪੰਜਾਬ ਦੇ ਵਿੱਚ ਬਹੁਤ ਸਾਰੇ ਤਿਉਹਾਰ ਅਤੇ ਲੋਕ ਤਿਉਹਾਰ ਮਨਾਏ ਜਾ ਰਹੇ ਹਨ ਪੰਜਾਬ ਦੇ ਵਿੱਚ ਵਿਸਾਖੀ ਹੋਲਾ ਮਹੱਲਾ ਲੋਹੜੀ ਬਸੰਤ ਪੰਚਮੀ ਦਵਾਲੀ ਤੀਆਂ ਰੱਖੜੀ ਪੰਜਾਬ ਦੇ ਬਹੁਤ ਸਾਰੇ ਤਿਉਹਾਰ ਅਤੇ ਕਲਚਰ ਹਨ ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਭੰਗੜਾ ਗਿੱਧਾ ਖਾਣਾ ਅਤੇ ਸੰਗੀਤ ਪੰਜਾਬ ਨੂੰ ਦੁਨੀਆਂ ਤੋਂ ਵੱਖਰਾ ਖੜ੍ਹਾ ਕਰਦਾ ਹੈ ਪੰਜਾਬ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਖਾਣੇ ਪਹਿਰਾਵੇ ਤਾਂ ਇਹ ਦੁਨੀਆਂ ਤੋਂ ਪੰਜਾਬੀਆਂ ਨੂੰ ਵੱਖਰਾ ਖੜ੍ਹਾ ਕਰਦਾ ਹੈ ਪੰਜਾਬ ਦੀ ਪੱਗ ਪਗੜੀ ਜੋ ਪੰਜਾਬ ਦੇ ਲੋਕਾਂ ਨੂੰ ਦੁਨੀਆਂ ਦੇ ਵਿੱਚ ਅਲੱਗ ਸਥਾਨ ਹਾਸਲ ਹਾਸਲ ਕੀਤਾ ਹੈ ਪੰਜਾਬ ਦੇ ਜੇਕਰ ਅਸੀਂ ਤਿਉਹਾਰਾਂ ਕਲਚਰ ਅਤੇ ਸੱਭਿਆਚਾਰ ਅਤੇ ਧਾਰਮਿਕ ਤਿਉਹਾਰਾਂ ਦੀ ਗੱਲ ਕਰੀਏ ਤਾਂ ਜਿਵੇਂ ਵਿਸਾਖੀ ਦਾ ਤਿਉਹਾਰ ਇਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੌਲ੍ਹਾਂ ਸੌ ਨੜ੍ਹਿਨਵੇਂ ਈਸਵੀ ਦੇ ਵਿੱਚ ਪੰਜਾਬੀ ਲੋਕਾਂ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਅੰਮ੍ਰਿਤ ਛਕਾਏ ਅਤੇ ਵਿਸਾਖੀ ਦਾ ਤਿਉਹਾਰ ਤੇਰ੍ਹਾਂ ਅਪ੍ਰੈਲ ਨੂੰ ਹਰ ਸਾਲ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ ਜੋ ਤੇਰ੍ਹਾਂ ਜਨਵਰੀ ਨੂੰ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ ਸਾਨੂੰ ਪ੍ਰਤੀਕ ਦਿੰਦਾ ਹੈ ਕਿ ਕੋੜ ਵੱਡੋ ਮਤਲਬ ਸੁਸਤੀ ਸੁਸਤੀ ਨੂੰ ਦੂਰ ਕਰੋ ਅਤੇ ਚੁਸਤੀ ਪੈਦਾ ਕਰੋ ਮਨਾਂ ਦੇ ਵਿੱਚ ਅਤੇ ਏਕਤਾ ਭਾਈਚਾਰਾ ਰੱਖੋ ਅਤੇ ਭੰਗੜਾ ਅਤੇ ਭੰਗੜਾ ਅਤੇ ਗਿੱਧਾ ਵੀ ਪੰਜਾਬ ਦੇ ਲੋਕਾਂ ਨੂੰ ਇੱਕ ਵੱਖਰਾ ਹੀ ਪਹਿਚਾਣ ਦਿੰਦਾ ਹੈ ਅਤੇ ਭੰਗੜੇ ਅਤੇ ਗਿੱਧੇ ਦੇ ਵਿੱਚ ਪੰਜਾਬੀਆਂ ਨੇ ਬਹੁਤ ਪ੍ਰਸਿੱਧੀ ਹਾਸਿਲ ਕੀਤੀ ਹੈ ਤੀਆਂ ਵਰਗੇ ਤਿਉਹਾਰ ਵੀ ਪੰਜਾਬ ਦੇ ਵਿੱਚ ਸੌਣ ਮਹੀਨੇ ਵਿੱਚ ਮਨਾਏ ਜਾਂਦੇ ਹਨ ਇਸ ਤਿਉਹਾਰ ਦੇ ਵਿੱਚ ਕੁੜੀਆਂ ਇਕੱਠੀਆਂ ਹੋ ਕੇ ਪੰਜਾਬ ਦਾ ਗਿੱਧਾ ਭੰਗੜਾ ਸੰਗੀਤ ਵਰਗੇ ਸਾਰੀਆਂ ਐਕਟੀਵਿਟੀਜ਼ ਪੰਜਾਬ ਦੇ ਕੁੜੀਆਂ ਮੁੰਡੇ ਕਰਦੇ ਹਨ ਅਤੇ ਇੱਕ ਦੂਜੇ ਨਾਲ ਭਾਈਚਾਰ ਸਾਂਝ ਰੱਖਦੇ ਹਨ ਅਤੇ ਪੰਜਾਬ ਦੇ ਵਿੱਚ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਰਗੇ ਤਿਉਹਾਰ ਵੀ ਮਨਾਏ ਜਾਂਦੇ ਹਨ ਜੋ ਸਰੀਰ ਦੀ ਚੁਸਤੀ ਅਤੇ ਸਰੀਰ ਦੀ ਫੁਰਤੀ ਦੇ ਲਈ ਲੋਕਾਂ ਦੇ ਵਿੱਚ ਜਾਗਰੂਕ ਪੈਦਾ ਕਰਦੇ ਹਨ